ਸਾਡੇ ਖੇਤਰ ਵਿੱਚ ਚਲਾਉਣ ਵਾਲੀਆਂ ਮੁੱਖ ਸਿਆਸੀ ਪਾਰਟੀਆਂ ਕਾਂਗਰੇਸ ਅਕਾਲੀ ਦਲ ਬੀ ਜੇ ਪੀ ਝਾੜੂ ਆਦਮੀ ਪਾਲਟੀ ਹੁਣ ਸਾਰੇ ਪਾਸੇ ਹੀ ਆਮ ਆਦਮੀ ਪਾਲਟੀ ਦਾ ਬਹੁਤ ਵਧੀਆ ਪ੍ਰਦਸ਼ਨ ਹੋ ਰਿਹਾ ਹੈ ਇਸ ਨੂੰ ਬ ਲੋਕਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਰੋਜ਼ਗਾਰ ਵੀ ਦੇ ਰਹੇ ਹਨ ਅਤੇ ਲੋਕਾਂ ਨੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਾਕੇ ਬਨਵੇਂ ਮੈਂ ਬਨਵੇਂ ਤੋਂ ਬਨਵੇਂ ਸੀਟਾਂ ਹਾਸਿਲ ਕੀਤੀਆਂ ਹਨ ਅਤੇ ਰੋਪੜ ਜ਼ਿਲ੍ਹੇ ਦੇ ਰੋਪੜ ਦੇ ਐੱਮ ਪੀ ਦਿਨੇਸ਼ ਚੱਡਾ ਹਨ